ਟੈਕਨੋਲਜੀ ਵਿੱਚ ਮੇਰੀ ਦਿਲਚਸਪੀ ਸੱਭ ਤੋਂ ਪਹਿਲਾਂ ਇੰਟਰਨੈੱਟ ਨੇ ਪੈਦਾ ਕੀਤੀ ਕਿਉਂਕਿ ਇੰਟਰਨੈੱਟ ਅੱਜ ਕੱਲ੍ਹ ਹਰ ਕੰਮ ਵਿੱਚ ਇਸਤੇਮਾਲ ਹੋਣ ਲੱਗ ਪਿਆ ਹੈ ਇੰਟਰਨੈੱਟ ਦੇ ਕਾਰਨ ਅੱਜ ਕੱਲ੍ਹ ਦੁਨੀਆਂ ਦੇ ਪੱਚਾਸੀ ਪਰਸੈਂਟ ਬੱਚੇ ਔਨਲਾਈਨ ਹੀ ਘਰ ਬੈਠ ਕੇ ਪੜ੍ਹ ਸਕਦੇ ਹਨ ਇੰਟਰਨੈੱਟ 'ਤੇ ਦੁਨੀਆਂ ਦਾ ਹਰ ਕੋਈ ਕੋ ਕੋਰਸ ਸਟੱਡੀਸ ਵੀ ਹਰ ਤਰ੍ਹਾਂ ਦੇ ਵੀਡੀਓ ਮੋਜੂਦ ਹਨ ਜਿਸ ਨਾਲ ਬੱਚਾ ਆਪਣਾ ਆਪਣੀ ਪੜ੍ਹਾਈ ਕਰ ਸਕਦਾ ਹੈ ਇਸ ਦੇ ਨਾਲ ਕ ਕਲਾਸਾਂ 'ਚ ਜਾਣ ਦਾ ਸਮੇਂ ਅਤੇ ਪੈਸਾ ਦੋਵੇਂ ਬਚਣਗੇ ਇਹਨਾਂ ਇੰਟਰਨੈੱਟ ਦੇ ਕਾਰਨ ਅੱਜ ਕੱਲ੍ਹ ਔਨਲਾਈਨ ਬੈਂਕਿੰਗ ਵਗੈਰਾ ਵੀ ਹੁੰਦੀ ਹੈ ਜਿਸ ਦੇ ਨਾਲ ਤੁਸੀਂ ਬੈਂਕ 'ਤੇ ਜਾਣ ਦਾ ਅਤੇ ਲਾਈਨ 'ਚ ਲੱਗਣ ਦਾ ਸਮਾਂ ਬਚਾ ਸਕਦੇ ਹੋ ਇੰਟਰਨੈੱਟ ਦੇ ਕਾਰਨ ਅੱਜ ਕੱਲ੍ਹ ਟਾਈਮ ਦੀ ਬ ਬਚਤ 'ਤੇ ਹੁੰਦੀ ਹੀ ਹੈ ਅਤੇ ਪੈਸੇ ਦੀ ਵੀ ਬਹੁਤ ਬਚਤ ਹੁੰਦੀ ਹੈ ਇੰਟਰਨੈੱਟ ਦੇ ਕਾਰਨ ਅੱਜ ਕੱਲ੍ਹ ਜੇ ਕਿਸੇ ਨੇ ਆਪਣਾ ਮਨੋਰੰਜਨ ਕਰਨਾ ਹੋਵੇ ਤਾਂ ਉਹਨੂੰ ਟੀਵੀ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਫੋਨ 'ਤੇ ਹੀ ਆਪਣਾ ਕੋਈ ਵੀ ਮਨੋ ਮਨੋਰੰਜਨ ਆਪਣੇ ਹਿਸਾਬ ਨਾਲ ਖੋਜ ਸਕਦਾ ਹੈ ਅਤੇ ਇੰਟਰਨੈੱਟ 'ਤੇ ਅੱਜ ਕੱਲ੍ਹ ਦੁਨੀਆਂ ਦੀ ਹਰ ਕੋਈ ਚੀਜ਼ ਦੀ ਇਨਫੋਰਮੇਸ਼ਨ ਮੋਜੂਦ ਹੈ ਮੈਨੂੰ ਇਹ ਇੰਟਰਨੈੱਟ ਦੀ ਗੱਲਾਂ ਬਹੁਤ ਪਸੰਦ ਆਈਆਂ ਇਸ ਲਈ ਮੈਂ ਇੰਟਰਨੈੱਟ ਤੋਂ ਬਹੁਤ ਪ੍ਰਭਾਵਿਤ ਹੋਇਆ